ਪਿੰਜਰੇ ਵਿੱਚ ਕੈਦ ਪੰਛੀਆਂ ਨੂੰ ਦੇਖ ਕੇ ਮੇਰੇ ਦਿਮਾਗ ਵਿੱਚ ਖਿਆਲ ਆਉਂਦਾ ਹੈ ਪੰਛੀਆਂ ਨੂੰ ਅਜਾਦ ਕਰਨਾ ਬਹੁਤ ਬੁਰੀ ਗੱਲ ਹੈ ਜਿਵੇਂ ਅਸੀਂ ਕਿਸੇ ਅਸੀਂ ਹਰ ਤਰ੍ਹਾਂ ਦੀ ਅਜਾਦੀ ਭਾਲਦੇ ਹਾਂ ਤਾਂ ਪੰਛੀ ਵੀ ਆਪਣੀ ਮਰਜੀ ਨਾਲ ਜਿਉਣਾ ਚਾਉਂਦੇ ਹਨ ਅੰਬਰਾਂ ਵਿੱਚ ਉੱਡਣਾ ਚਾਉਂਦੇ ਹਨ ਮੈਨੂੰ ਸ਼ੁਰੂ ਤੋਂ ਹੀ ਸ਼ੌਂਕ ਹੈ ਕੀ ਪੰਛੀਆਂ ਨੂੰ ਉੱਡਦੇ ਹੋਏ ਅਸਮਾਨ ਵਿੱਚ ਦੇਖਾਂ ਇਹ ਦੇਖਣ ਲਈ ਮੈਂ ਹਰ ਰੋਜ ਆਪਣੇ ਘਰ ਦੀ ਛੱਤ ਤੇ ਜਾਂਦੀ ਹਾਂ ਅਤੇ ਉੱਡਦੇ ਹੋਏ ਅਕ ਅਕਾਸ਼ ਵਿੱਚ ਉੱਡਦੇ ਹੋਏ ਪੰਛੀਆਂ ਨੂੰ ਦੇਖਦੀ ਹਾਂ ਅਤੇ ਮੇਰਾ ਮਨ ਬਹੁਤ ਖੁਸ਼ ਹੁੰਦਾ ਹੈ ਬਚਪਨ ਵਿੱਚ ਇੱਕ ਵਾਰ ਮੇਰੇ ਦਾਦਾ ਜੀ ਨੇ ਇੱਕ ਤੋਤੇ ਨੂੰ ਪਿੰਜਰੇ ਵਿੱਚ ਰੱਖਿਆ ਹੋਇਆ ਸੀ ਲੇਕਿਨ ਤਦ ਅਸੀਂ ਦੇਖ ਕੇ ਉਸਨੂੰ ਬਹੁਤ ਖੁਸ਼ ਹੁੰਦੇ ਸਾਂ ਲੇਕਿਨ ਥੋੜੇ ਸਮੇਂ ਬਾਦ ਮੇਰੇ ਮਨ ਵਿੱਚ ਖਿਆਲ ਆਉਣ ਲੱਗਾ ਕੀ ਅਸੀਂ ਕਿਸੇ ਦੀ ਕੈਦ ਵਿੱਚ ਨਹੀਂ ਰਹਿ ਸਕਦੇ ਤਾਂ ਇਹ ਪੰਛੀ ਵੀ ਕੀ ਸੋਚਦਾ ਹੋਏਗਾ ਇਹ ਵੀ ਆਪਣੇ ਆਪਨੂੰ ਅਜਾਦ ਕਰਨਾ ਚਾਉਂਦਾ ਹੋਏਗਾ ਉਸ ਨੂੰ ਪਿੰਜਰੇ ਵਿੱਚ ਖਾਣ ਪੀਣ ਨੂੰ ਮਿਲ ਤਾਂ ਸਭ ਕੁਛ ਰਿਹਾ ਸੀ ਪਰ ਉਸਦੇ ਸਾਥੀ ਜਾਂ ਉਸ ਦਾ ਕਬੀਲਾ ਉਸਦੇ ਨਾਲ ਨਹੀਂ ਸੀ ਇਸ ਲਈ ਇੱਕ ਦਿਨ ਮੈਂ ਬਹੁਤ ਹੌਂਸਲਾ ਕਰਕੇ ਪਿੰਜਰੇ ਨੂੰ ਖੋਲ ਦਿੱਤਾ ਅਤੇ ਤੋਤੇ ਨੂੰ ਅਜਾਦ ਕਰ ਦਿੱਤਾ ਇਸ ਗੱਲ ਲਈ ਭਾਵੇਂ ਮੈਨੂੰ ਬਹੁਤ ਹੀ ਨਰਾਜਗੀ ਦਾ ਸਾ ਦਾਦਾ ਜੀ ਤੋਂ ਬਹੁਤ ਹੀ ਨਰਾਜਗੀ ਸਾਮਣਾ ਕਰਨਾ ਪਿਆ ਪਰੰਤੂ ਇਹ ਕੰਮ ਕਰਕੇ ਮੇਰਾ ਮਨ ਬਹੁਤ ਖੁਸ਼ ਹੋਇਆ